ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ਦਾ ਬਹੁਤ ਹੀ ਪ੍ਰਮੁੱਖ ਅਤੇ ਪ੍ਰਸਿੱਧ ਜ਼ਿਲ੍ਹਾ ਹੈ ਇੱਥੇ ਹਰ ਸਾਲ ਲੱਖਾਂ ਅਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਅਤੇ ਪ੍ਰਯਟਕ ਹੁੰਮ ਹੁੰਮਾ ਕੇ ਘੁੰਮਣ ਲਈ ਅਤੇ ਗੁਰੂ ਸਾਹਿਬ ਦੇ ਘਰਾਂ ਦੇ ਦਰਸ਼ਨਾਂ ਲਈ ਪਹੁੰਚਦੀਆਂ ਹਨ ਇੱਥੇ ਬਹੁਤ ਹੀ ਪ੍ਰਮੁੱਖ ਅਤੇ ਪ੍ਰਸਿੱਧ ਤੀਰਥ ਅਸਥਾਨ ਹਨ ਜਿਹਨਾਂ ਵਿੱਚੋਂ ਦੋ ਹਨ ਹਰਿਮੰਦਰ ਸਾਹਿਬ ਅਤੇ ਹਿੰਦੂਆਂ ਦਾ ਦੁਰਗਿਆਨਾ ਮੰਦਿਰ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਹਨ ਸੋ ਇੱਥੋਂ ਦੇ ਜਿਹੜੀ ਮਾਰਕੀਟ ਹੈ ਉੱਥੇ ਕੱਪੜੇ ਦਾ ਕੰਮ ਖਾਣ ਪੀਣ ਦਾ ਕੰਮ ਢਾਬੇ ਹੋਟਲ ਇਹ ਸਭ ਕਿੱਤੇ ਲੋਕਾਂ ਨੇ ਬਹੁਤ ਜ਼ਿਆਦਾ ਅਪਣਾ ਲਏ ਹਨ ਪਿਛਲੇ ਦਸ਼ਕ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕਾਂ ਨੇ ਆਪਣੇ ਜੀਵਨ ਸਥਰ ਨੂੰ ਬਹੁਤ ਹੀ ਉੱਚਾ ਬਣਾ ਲਿਆ ਹੈ ਰੁਜ਼ਗਾਰ ਦੇ ਬਹੁਤ ਹੀ ਸਾਧਨ ਬਣ ਚੁੱਕੇ ਹਨ ਲੋਕ ਵੱਖਰੇ ਵੱਖਰੇ ਜਗ੍ਹਾ ਵਿੱਚ ਹੋਟਲ ਬਣਾ ਰਹੇ ਹਨ ਢਾਬੇ ਬਣਾ ਰਹੇ ਹਨ ਅਤੇ ਸ਼ ਸ਼ਰਧਾਲੂਆਂ ਲਈ ਬਹੁਤ ਹੀ ਸ ਜ਼ਿਆਦੀਆਂ ਸਹੂਲਤਾਂ ਉਪਲਬਧ ਕਰਵਾ ਰਹੇ ਹਨ ਲੋਕ ਇੱਥੇ ਖੇਤੀਬਾੜੀ ਦਾ ਕੰਮ ਵੀ ਬਹੁਤ ਅਪਣਾਉਂਦੇ ਹਨ ਖੇਤੀਬਾੜੀ ਦਾ ਕਿੱਤਾ ਇੱਥੇ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਖੇਤੀ ਨੂੰ ਬਹੁਤ ਹੀ ਮਾਨਤਾ ਪ੍ਰਾਪਤ ਹੈ ਇੱਥੋਂ ਦੀ ਮਿੱਟੀ ਬਹੁਤ ਉਪਜਾਊ ਹੈ ਇਸ ਕਰਕੇ ਅੰਮ੍ਰਿਤਸਰ ਵਿੱਚ ਖੇਤੀਬਾੜੀ ਦਾ ਕੰਮ ਵੀ ਬਹੁਤ ਉੱਚੇ ਪੱਧਰ 'ਤੇ ਕੀਤਾ ਜਾਂਦਾ ਹੈ ਹਰ ਘਰ ਦੀਆਂ ਬੀਬੀਆਂ ਨੂੰ ਅੱਜ ਕੱਲ੍ਹ ਨਵੇਂ ਕੱਪੜੇ ਸਵਾਉਣ ਦਾ ਬਹੁਤ ਹੀ ਸ਼ੌਕ ਹੈ ਇਸ ਕਰਕੇ ਇੱਥੋਂ ਦੇ ਲੋਕਾਂ ਵਿੱਚ ਬੁਟੀਕ ਖੋਲ੍ਹਣ ਦਾ ਵੀ ਕਿੱਤਾ ਬਹੁਤ ਅਪਣਾਇਆ ਜਾਂਦਾ ਹੈ ਹਰ ਘਰ ਦੀਆਂ ਬੀਬੀਆਂ ਤਿਆਰ ਸ਼ਿਆਰ ਹੋਣ ਲਈ ਪਾਰਲਰਾਂ 'ਤੇ ਵੀ ਜਾਂਦੀਆਂ ਹਨ ਇਸ ਕਰਕੇ ਕੁਝ ਜਨਾਨੀਆਂ ਪਾਰਲਰਾਂ ਦਾ ਕੰਮ ਸਿੱਖ ਕੇ ਵੱਖਰੇ ਵੱਖਰੇ ਪਾਰਲਰ ਖੋਲ੍ਹਦੀਆਂ ਹਨ ਜਿੱਥੇ ਵੱਖਰੇ ਵੱਖਰੇ ਆਧੁਨਿਕ ਢੰਗ ਦੇ ਮੇਕਅਪ ਕੀਤੇ ਜਾਂਦੇ ਹਨ ਸੋ ਦੇਖਿਆ ਜਾਵੇ ਤਾਂ ਇੱਥੋਂ ਦੀ ਆਰਥਿਕ ਸਥਿਤੀ ਇਹ ਬਹੁਤ ਸਾਰੇ ਚੀਜ਼ਾਂ 'ਤੇ ਨਿਰਭਰ ਕਰਦੀ ਹੈ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਪੰਜਾਬ ਵਿੱਚ ਨਾਟਸ਼ਾਲਾ ਵੀ ਮੌਜੂਦ ਹੈ ਜਿੱਥੇ ਵੱਖਰੇ ਵੱਖਰੇ ਅਦਾਕਾਰਾਂ ਨੂੰ ਅਦਾਕਾਰ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ ਆਪਣੇ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਅਦਾਕਾਰ ਨਿਕਲੇ ਹਨ ਜਿਵੇਂ ਕਿ ਕਪਿਲ ਸ਼ਰਮਾ ਅਤੇ ਅਕਸ਼ੈ ਕੁਮਾਰ ਇਹ ਸਭ ਅੱਜ ਕੱਲ੍ਹ ਬੋਲੀਵੁੱਡ ਵਿੱਚ ਬਹੁਤ ਨਾਮ ਕਮਾ ਰਹੇ ਹਨ ਸੋ ਦੇਖਿਆ ਜਾਵੇ ਤਾਂ ਇਸ ਜ਼ਿਲ੍ਹੇ ਦੀ ਆਰਥਿਕਤਾ ਅਤੇ ਜੀਵਨ ਢੰਗ ਵਿੱਚ ਬਹੁਤ ਯੋਗਦਾਨ ਪਾਇਆ ਹੈ ਇਹਨਾਂ ਕਿੱਤਿਆਂ ਨੇ ਇੱਥੋਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧੀ ਹੈ ਲੋਕਾਂ ਨੇ ਆਪਣੇ ਆਪ ਨੂੰ ਆਤਮ ਨਿਰਭਰ ਬਣਾ ਲਿਆ ਹੈ ਰੁਜ਼ਗਾਰ ਦੇ ਸਾਧਨ ਵਧੇ ਹਨ ਜੀਵਨ ਸਥਰ ਲੋਕਾਂ ਦਾ ਉੱਚਾ ਹੋ ਗਿਆ ਹੈ ਦੇਖਿਆ ਜਾਵੇ ਜੀਵਨ ਸਥਰ ਉੱਚਾ ਹੋਣ ਦੇ ਕਰਕੇ ਆਮ ਘਰ ਵਿੱਚ ਆਧੁਨਿਕ ਸੁੱਖ ਸੁਵਿਧਾਵਾਂ ਦਾ ਵਾਧਾ ਹੋ ਗਿਆ ਹੈ ਸੋ ਆਪਣਾ ਪੰਜਾਬ ਦਾ ਪ੍ਰਮੁੱਖ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਕਿੱਤਿਆਂ ਵਜੋਂ ਹੀ ਜਾਣਿਆ ਜਾਂਦਾ ਹੈ